ਸਾਨੂੰ ਹੁਣ ਤੱਕ ਇਹੀ ਪੜ੍ਹਾਇਆ ਜਾਂਦਾ ਹੈ ਕਿ ਸਿੱਖਾਂ ਦੇ ਧਰਮ ਅਤੇ ਰਾਜਨੀਤੀ ਇਕੱਠ ਹਨ ਧਰਮ ਅਤੇ ਰਾਜਨੀਤੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਉਹ ਅਕਾਲ ਤਖਤ ਸਾਹਿਬ ਦੇ ਸਾਹਵੇਂ ਲੱਗੇ ਦੋ ਇਕੱਠੇ ਨਿਸ਼ਾਨ ਸਾਹਿਬ ਨੂੰ ਮਿਸਾਲ ਵਜੋਂ ਵਰਤਦੇ ਹਨ ਬਿਨਾਂ ਇਸ ਗੱਲ ਦੀ ਤਸਦੀਕ ਕੀਤਿਆਂ ਕਿ ਉਹ ਮਹਾਰਾਜਾ ਸ਼ੇਰ ਸਿੰਘ ਨੇ ਕਿਉਂ ਲਵਾਏ ਅਸੀਂ ਮੰਨ ਲੈਂਦੇ ਹਾਂ ਮੰਨਦੇ ਆ ਰਹੇ ਹਾਂ ਪਰ ਸਾਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਸਾਡੀ ਰਾਜਨੀਤੀ ਕਿਹੜੀ ਹੈ ਜਿਹੜੀ ਧਰਮ ਨਾਲੋਂ ਨਖੇੜੀ ਨਹੀਂ ਜਾ ਸਕਦੀ ਕੀ ਰੂਪ ਰੇਖਾ ਸਾਡੀ ਰਾਜਨੀਤੀ ਦੀ ਹੈ ਕਿੰਝ ਦੀ ਹੈ ਸਾਡੀ ਰਾਜਨੀਤੀ ਅੱਜ ਕੱਲ੍ਹ ਕੀ ਹੁੰਦਾ ਹੈ ਗੁਰਦੁਆਰਿਆਂ ਵਿੱਚ ਧਰਮ ਦੇ ਨਾਂ 'ਤੇ ਜਿਹੜੇ ਉਹ ਇਕੱਠੀ ਧਰਮ ਦੇ ਨਾਲ ਪਹਿਲਾਂ ਕੁਝ ਅਲੱਗ ਨਹੀਂ ਉੱਥੇ ਕੀਰਤਨੀਆਂ ਅ ਕੀਰਤਨ ਕਰੀ ਜਾਂਦਾ ਹੈ ਭਾਈ ਅਰਦਾਸਾਂ ਕਰੀ ਜਾਂਦਾ ਹੈ ਕਥਾ ਵਾਚਕ ਕਥਾ ਕਰੀ ਜਾਂਦਾ ਹੈ ਸਭ ਤੋਂ ਉੱਚੇ ਸੱਚ ਦੇ ਜੀਵਨ ਦਾ ਆਧਾਰ ਹੈ ਉੱਥੇ ਹੀ ਸਾਰੇ ਜਹਾਨ ਦੇ ਝੂਠੇ ਰਾਜਨੀਤਿਕ ਆਪਣੇ ਭਾਸ਼ਣ ਝਾੜੀ ਜਾਂਦੇ ਹਨ ਪ੍ਰਬੰਧ ਉੱਥੇ ਝੂਠਾ ਉਹਨਾਂ ਦੇ ਝੂਠਾਂ ਦਾ ਗੁੰਡਾ ਬੰਨੀ ਜਾਂਦੇ ਹਨ ਤੁਰਨ ਲੱਗਿਆਂ ਗੱ ਉਹਨਾਂ ਦੇ ਗੱਲ ਵਿੱਚ ਸਰੋਪਾ ਪਾ ਦਿੰਦੇ ਹਨ ਨਗਰ ਕੀਰਤਨ ਦੇ ਭਰਵੇਂ ਇਕੱਠ ਵਿੱਚ ਰਾਜਨੀਤਿਕਾਂ ਨੂੰ ਬੁਲਾ ਕੇ ਤੁਹਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਭਲਾ ਕੀ ਸਾਬਿਤ ਕਰਨਾ ਚਾਹੁੰਦੇ ਹਨ ਤੁਸੀਂ ਕੀ ਇਹਨਾਂ ਨੂੰ ਸੁਣਨ ਜਾਂਦੇ ਹੋ ਨਗਰ ਕੀਰਤਨ ਦੀ ਰਾਜਨੀਤੀ ਲੋਕਾਂ ਲਈ ਹਨ ਕਿਉਂ ਇਸਦੇ ਝੂਠ ਨੂੰ ਸੱਚ ਦੇ ਸਾਹਵੇਂ ਸਨਮਾਨਿਤ ਕੀਤਾ ਜਾਂਦਾ ਹੈ ਜੋ ਕਿ ਬਹੁਤ ਗਲਤ ਹੈ ਧਰਮ ਦੇ ਨਾਮ 'ਤੇ ਵਪਾਰ ਵਜੋਂ ਵੀ ਵਰਤਿਆ ਜਾਂਦਾ ਹੈ ਰਾਜਨੀਤਿਕ ਨੂੰ ਰਾਜਨੀਤੀਕ ਨੂੰ